ਮੈਂ ਆਪਣੇ ਲੰਬੇ ਬਾਈਕਿੰਗ ਸਫ਼ਰ 'ਤੇ ਸਿਹਤਮੰਦ ਰਹਿਣ ਲਈ ਕੁਛ ਚੀਜ਼ਾਂ ਦਾ ਧਿਆਨ ਰੱਖਦਾ ਹੈ ਸਭ ਤੋਂ ਪਹਿਲਾਂ ਮੈਂ ਆਪਣੀ ਬਾਈਕ ਦੀ ਫਿਟ ਸਹੀ ਕਰਵਾਉਂਦਾ ਹਾਂ ਤਾਂ ਕਿ ਮੇਰੀ ਬਾਡੀ 'ਤੇ ਕੋਈ ਸਟਰੇਨ ਨਾ ਪਵੇ ਦੂਜਾ ਮੈਂ ਰੈਗੂਲਰ ਬ੍ਰੇਕਸ ਲੈਂਦਾ ਹਾਂ ਤਾਂ ਕਿ ਮੇਰਾ ਕੋਈ ਮਸਲ ਇੱਦਾਂ ਖਿੱਚ ਨਾ ਹੋਵੇ ਤੀਜਾ ਮੈਂ ਸਹੀ ਖਾਣਾ ਖਾਂਦਾ ਹਾਂ ਅਤੇ ਪਾਣੀ ਖੂਬ ਪੀਂਦਾ ਹਾਂ ਤਾਂ ਕਿ ਮੇਰੀ ਪਾਣੀ ਦੀ ਸਾਰੀ ਕਮੀ ਪੂਰੀ ਹੋ ਜਾਵੇ ਸੜਕ 'ਤੇ ਮੈਂ ਯੂਜਲੀ ਹੈਲਦੀ ਸਨੈਕਸ ਖਾਂਦਾ ਹਾਂ ਜਿਵੇਂ ਕਿ ਫਰੂਟਸ ਨਟਸ ਜਾਂ ਪ੍ਰੋਟੀਨ ਵਾਰ ਮੈਂ ਪੈਕਜ ਫੂਡ ਤੋਂ ਪਰਹੇਜ ਕਰਦਾ ਹਾਂ ਕਿਉਂਕਿ ਉਹ ਅਨਹੈਲਦੀ ਹੁੰਦੇ ਹਨ ਅਤੇ ਸਾਨੂੰ ਉਹ ਨਹੀਂ ਖਾਣੇ ਚਾਹੀਦੇ ਹਾਂ ਮੈਨੂੰ ਕਦੇ ਕਦੇ ਪਿੱਠ ਦਰਦ ਜਾਂ ਮੋਢੇ ਦਾ ਦਰਦ ਹੋ ਜਾਂਦਾ ਹੈ ਖ਼ਾਸ ਕਰ ਜਦੋਂ ਮੈਂ ਬਹੁਤ ਲੰਬੇ ਸਫ਼ਰ 'ਤੇ ਤੱਕ ਬਾਈਕ ਚਲਾ ਰਿਹਾ ਹੁੰਦਾ ਹਾਂ ਪਰ ਮੈਂ ਸਟਰੈਚਿੰਗ ਕਰਕੇ ਅਤੇ ਥੋੜ੍ਹਾ ਰੈਸਟ ਕਰਕੇ ਇਸਨੂੰ ਮੈਨੇਜ ਕਰ ਲੈਂਦਾ ਹਾਂ